ਅੰਗਰੇਜ਼ਾਂ ਦੁਆਰਾ ਪੰਜਾਬ ਵਿੱਚ ਬਹੁਤ ਤਰੀਕੇ ਦੀ ਆਰਥਿਕ ਨੀਤੀਆਂ ਲਾਗੂ ਕੀਤੀਆਂ ਗਈਆਂ ਸੀ ਜਿਵੇਂ ਕਿ ਉਹਨਾਂ ਨੇ ਬਹੁਤ ਸਾਰੇ ਪ੍ਰਕਾਰ ਦੇ ਕਰ ਲਾ ਦਿੱਤੇ ਸੀ ਜੇ ਇਹਨਾਂ ਨੇ ਬਹੁਤ ਹੀ ਬੁਰਾ ਅਸਰ ਪਾਇਆ ਉਹਨਾਂ ਦੁਆਰਾ ਨੀਤੀਆਂ ਜਿਵੇਂ ਕਿ ਖੇਤੀ ਉੱਤੇ ਕਰ ਜਿੰਨਾ ਵੀ ਖੇਤ ਉੱਤੇ ਉਪਜ ਹੁੰਦੀ ਸੀ ਉਸ ਵਿੱਚੋਂ ਉਹ ਬਹੁਤ ਸਾਰੀਆਂ ਚੀਜ਼ਾਂ ਆਪਣੇ ਕੋਲ ਰੱਖ ਲੈਂਦੇ ਸੀ ਜਿਸ ਤੋਂ ਖੇਤੀ ਕਰਨ ਵਾਲਿਆਂ ਕੋਲ ਆਪ ਦੀ ਚੀਜ਼ ਨਹੀਂ ਬੱਚਦੀ ਸੀ